ਭਾਰਤ ਦਾ ਸਭ ਤੋਂ ਮਹੱਤਵਪੂਰਨ ਵਾਤਾਵਰਨ ਦਾ ਮੁੱਦਾ ਹੈ ਪਾਣੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਗੱਡੀਆਂ ਦਾ ਧੂੰਆਂ ਫੈਕਟਰੀਆਂ ਦਾ ਧੂੰਆਂ ਜਿਹਦੇ ਕਰਕੇ ਸਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਸਾਨੂੰ ਸਾਹ ਲੈਣ ਵਿੱਚ ਕਈ ਪ੍ਰੋਬਲਮਾਂ ਕਈ ਦਿੱਕਤ ਆਉਂਦੀ ਹੈ ਜਿਵੇਂ ਕਿ ਤੁਸੀਂ ਮਨੁੱਖ ਦਿਨੋ ਦਿਨ ਹੀ ਰੁੱਖ ਕੱਟਦਾ ਜਾ ਰਿਹਾ ਹੈ ਉਹਦੇ ਕਰਕੇ ਵੀ ਸਾਨੂੰ ਓਕਸੀਜਨ ਦੀ ਕਮੀ ਹੁੰਦੀ ਹੈ ਜਿਵੇਂ ਕਿ ਪਾਣੀ ਪ੍ਰਦੂਸ਼ਣ ਆਪਾਂ ਕਹਿ ਸਕਦੇ ਹਾਂ ਕਿ ਫੈਕਟਰੀਆਂ ਦਾ ਪਾਣੀ ਜਿਹੜਾ ਕਿ ਸਮੁੰਦਰਾਂ ਵਿੱਚ ਜਾਂਦਾ ਹੈ ਜਿਹਦੇ ਕਰਕੇ ਸਮੁੰਦਰ ਦਾ ਪਾਣੀ ਵੀ ਦੂਸ਼ਿਤ ਹੁੰਦਾ ਹੈ ਅਤੇ ਨਦੀਆਂ ਵਿੱਚ ਵੀ ਜਾਂਦਾ ਹੈ ਜਿਹਦੇ ਕਰਕੇ ਨਦੀਆਂ ਦਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ ਖੇਤਾਂ ਵਿੱਚ ਜਾਂਦਾ ਹੈ ਜਿਹਦੇ ਕਰਕੇ ਜਿਹੜੇ ਆਪਾਂ ਸਬਜ਼ੀ ਚਾਵਲ ਆ ਖਾਂ ਖਾਂਦੇ ਹਾਂ ਉਹਦੇ ਕਰਕੇ ਸਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਇਹ ਪਾਣੀ ਧਰਤੀ ਹੇਠਲਾ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ ਜਿਸ ਦੇ ਕਰਕੇ ਸਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਵੇਂ ਕਿ ਆਪਾਂ ਮੌਸਮ ਦੀ ਗੱਲ ਕਰੀਏ ਜਿਵੇਂ ਕਿ ਦਿਨੋ ਦਿਨ ਹੀ ਰੁੱਖ ਕੱਟੇ ਜਾ ਰਹੇ ਹਨ ਜਿਹਦੇ ਕਰਕੇ ਗਰਮੀ ਵੀ ਦਿਨੋ ਦਿਨ ਵੱਧ ਰਹੀ ਹੈ ਅਤੇ ਸਰਦੀ ਘੱਟ ਰਹੀ ਹੈ